ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਇਨਡਰਾਈਵ ਤੋਂ ਬੋਲ ਰਹੇ ਹੋ ਮੈਂ ਆਪਣੀ ਕੈਬ ਬੁੱਕ ਕਰਨੀ ਸੀ ਕੱਲ੍ਹ ਲਈ ਹਾਂਜੀ ਹਾਂਜੀ ਕੱਲ੍ਹ ਸਵੇਰੇ ਸੱਤ ਵਜੇ ਦੀ ਹਾਂਜੀ ਅਤੇ ਮੈਂ ਸਨੀ ਇਨਕਲੇਵ ਤੋਂ ਤੁਸੀਂ ਮੈਨੂੰ ਪਿੱਕ ਕਰ ਸਕਦੇ ਹੋ ਮੋਹਾਲੀ ਏਅਰਪੋਰਟ ਤੋਂ ਹਾਂਜੀ ਮੋਹਾਲੀ ਏਅਰਪੋਰਟ ਤੱਕ ਜਾਣਾ ਆ ਸਵੇਰੇ ਸੱਤ ਵਜੇ ਹਾਂਜੀ ਅਤੇ ਤੁਸੀਂ ਮੈਨੂੰ ਆਪਣਾ ਕਿੰਨਾ ਪੇ ਕਰਨਾ ਮੈਨੂੰ ਇੱਕ ਵਾਰ ਉਹ ਵੀ ਦੱਸ ਦਿਉ ਹਾਂਜੀ ਤਾਂ ਤੁਸੀਂ ਟਾਈਮ ਨਾਲ ਪਹੁੰਚ ਜਾਵੋਂਗੇ ਸਵੇਰੇ ਸੱਤ ਵਜੇ ਹਾਂਜੀ ਸਨੀ ਇਨਕਲੇਵ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ